ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਨਰਸ ਬੋਲ ਰਹੀ ਹਾਂ ਸਿਵਿਲ ਹੋਸਪੀਟਲ ਤੋਂ ਹਾਂਜੀ ਦੱਸੋ ਹਾਂਜੀ ਠੀਕ ਹੈ ਜੀ ਕਿਸ ਦਿਨ ਆਏ ਸੀ ਤੁਸੀਂ ਠੀਕ ਹੈ ਤੁਸੀਂ ਟੈਸਟ ਵਗੈਰਾ ਕਰਵਾਏ ਹੋਏ ਆ ਪਹਿਲਾਂ ਠੀਕ ਹੈ ਕੋਈ ਸ਼ੂਗਰ ਵਗੈਰਾ ਤਾਂ ਨਹੀਂ ਤੁਹਾਨੂੰ ਕੋਈ ਕਿਸੇ ਟਾਈਮ ਪਹਿਲਾਂ ਜਾਂ ਸਾਲ ਪਹਿਲਾਂ ਕੋਈ ਇੰਜਰੀ ਵਗੈਰਾ ਹੋਈ ਹੋਏ ਠੀਕ ਹੈ ਮਤਲਬ ਤੁਹਾਨੂੰ ਕਮਜ਼ੋਰ ਮਹਿਸੂਸ ਹੁੰਦਾ ਉੱਠਣ ਵਗੈਰਾ ਲੱਗਿਆਂ ਚੱਕਰ ਵਗੈਰਾ ਆਉਂਦੇ ਨੇ ਠੀਕ ਹੈ ਠੀਕ ਹੈ ਜੀ ਸਾਡਾ ਕੈਂਪ ਲੱਗਦਾ ਆ ਦੋ ਦਿਨ ਮੰਗਲਵਾਰ ਔਰ ਵੀਰਵਾਰ ਅਤੇ ਤੁਸੀਂ ਪਹੁੰਚਿਓ ਸਿਵਿਲ ਹੋਸਪਿਟਲ ਗੁਰਦਾਸਪੁਰ ਅਤੇ ਤੁਸੀਂ ਆ ਕੇ ਮੈਨੂੰ ਮਿਲਿਓ ਮੇਰਾ ਨਾਮ ਤਾਨੀਆ ਹੈ ਤੁਸੀਂ ਮੈਨੂੰ ਮਿਲਣਾ ਫਿਰ ਮੈਂ ਤੁਹਾਨੂੰ ਟੈਸਟ ਵਗੈਰਾ ਲਿਖ ਦਊਂਗੀ ਫਿਰ ਤੁਸੀਂ ਕਰਵਾ ਲਿਓ ਓਕੇ ਮੈਂ ਪੰਦਰ੍ਹਾਂ ਨੰਬਰ ਰੂਮ 'ਚ ਹੋਵਾਂਗੀ ਚਲੋ ਠੀਕ ਆ ਫਿਰ ਓਕੇ ਟੇਕ ਕੇਅਰ ਤੁਸੀਂ ਮਿਲ ਲਿਓ ਮੈਨੂੰ ਬਾਏ